ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਸਮਾਜ ਹੈ ਉਹ ਔਰਤਾਂ ਸਥਾਨਕ ਜਿਹੜੀ ਔਰਤਾਂ ਹਨ ਉਹਨਾਂ ਨੂੰ ਡਾਂਸ ਕਰਨ ਦੀ ਇਜਾਜ਼ਤ ਤਾਂ ਨਹੀਂ ਦਿੰਦਾ ਸੀ ਪਰ ਜਿਵੇਂ ਜਿਵੇਂ ਸਾਡਾ ਸਮਾਜ ਵੱਧਦਾ ਗਿਆ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਆਉਂਦਾ ਗਿਆ ਤਾਂ ਇਸ ਕਰਕੇ ਜਿਹੜਾ ਸਾਡਾ ਸਮਾਜ ਹੈ ਉਹ ਹੌਲੀ ਹੌਲੀ ਨਵੇਂ ਨਵੇਂ ਤਰੀਕਿਆਂ ਨੂੰ ਸਿੱਖ ਰਿਹਾ ਹੈ ਅਤੇ ਅੱਜ ਕੱਲ੍ਹ ਉਹ ਇੰਨੇ ਜ਼ਿਆਦਾ ਓਪਨ ਮਾਈਡਿੰਡ ਲੋਕ ਹੋ ਗਏ ਹਨ ਕਿ ਉਹ ਅੱਜ ਕੱਲ੍ਹ ਜਿਹੜੇ ਔਰਤਾਂ ਹੈ ਉਹਨਾਂ ਨੂੰ ਡਾਂਸ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ ਪਰ ਫੇਰ ਵੀ ਕੁੜੀਆਂ ਨੂੰ ਕਾਫ਼ੀ ਜਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਬੇਟਾਇਮ ਕਿਤੇ ਵੀ ਬਾਹਰ ਜਾ ਕੇ ਕਿਤੇ ਵੀ ਪ੍ਰਫੋਰਮੈਂਸ ਲਈ ਨਹੀਂ ਜਾ ਸਕਦੇ ਉਨ੍ਹਾਂ ਨੂੰ ਦਿਨ ਦੇ ਵਿੱਚ ਹੀ ਕੋਈ ਵੀ ਜਿਹੜੀ ਐਕਟੀਵੀਟੀ ਹੈ ਉਹ ਕਰਨੀ ਪੈਂਦੀ ਹੈ ਜੇ ਉਹ ਕਿੱਥੇ ਸਿੱਖਣਾ ਚਾਹੁੰਦੇ ਹਨ ਜਾਂ ਕੁਛ ਸਿਖਾਉਣਾ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਦਿਨ ਜਾਂ ਸਮੇਂ ਸਿਰ ਹੀ ਕਰਨਾ ਪੈਂਦਾ ਹੈ ਸਾਡਾ ਜਿਹੜਾ ਸਥਾਨਕ ਜਿਹੜੀ ਸਿਚੁਏਸ਼ਨ ਹੈ ਉਹ ਐਨੀ ਸੇਫ਼ ਨਹੀਂ ਹੈ ਜਾਂ ਸੇਫ਼ ਐਨੀ ਮੰਨੀ ਨਹੀਂ ਜਾਂਦੀ ਜਿਹਦੇ ਕਰਕੇ ਕੁੜੀਆਂ ਨੂੂੰ ਇਸ ਤਰੀਕੇ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ